ਨਮਸਕਾਰ ਭਾਅ ਜੀ ਹੋਰ ਸੁਣਾਓ ਠੀਕ ਠਾਕ ਹੋਰ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਉਹ ਮੈਂ ਨਾ ਗ ਬਦਲੀ ਮੇਰੀ ਦੂਰ ਹੋ ਗਈ ਸੀ ਅਤੇ ਫਿਰ ਤਾਂ ਕਰਕੇ ਆਉਣ ਜਾਣ ਦਾ ਨਹੀਂ ਲੱਗਿਆ ਛੁੱਟੀ ਵੀ ਨਹੀਂ ਮਿਲਦੀ ਪਈ ਹੁਣ ਵਾ ਵਾ ਦਿਨਾਂ ਬਾਅਦ ਛੁੱਟੀ ਮਿਲੀ ਹੈ ਅਤੇ ਆਏ ਹਾਂ ਘਰ ਅਤੇ ਮੈ ਕਿਹਾ ਚਲੋ ਭਾਅ ਜੀ ਨੂੰ ਦੁਕਾਨ 'ਤੇ ਮਿਲਕੇ ਚਲਦੇ ਹਾਂ ਹੋਰ ਸੁਣਾਓ ਤੁਸੀਂ ਪਰਿਵਾਰ ਸਭ ਠੀਕ ਠਾਕ ਬਸ ਵਧੀਆ ਠੀਕ ਆ ਆਪਣਾ ਵੀ ਠੀਕ ਆ ਭਾਅ ਜੀ ਉਹ ਭਾਅ ਜੀ ਤੁਹਾਡੇ ਤੋਂ ਫੋਨ ਲੈ ਗਿਆ ਸੀ ਫੋਨ ਤਾਂ ਬਹੁਤ ਹੀ ਵਧੀਆ ਤੁਹਾਡਾ ਕੀ ਦੱਸਾਂ ਮੈਂ ਤੁਹਾਨੂੰ ਕਿ ਬਹੁਤ ਹੀ ਵਧੀਆ ਫੋਨ ਤੁਹਾਡਾ ਛੋਟਾ ਬੱਚਾ ਤਾਂ ਸੁੱਟ ਵੀ ਦਿੰਦਾ ਥੱਲੇ ਚਾਰ ਪੰਜ ਵਾਰ ਉਹਨੇ ਸੁੱਟ ਵੀ ਦਿੱਤਾ ਪਰ ਉਹ ਫੋਨ ਨੂੰ ਕੁਛ ਨਹੀਂ ਹੋਇਆ ਫੋਨ ਇਕਦਮ ਬਿਲਕੁਲ ਸਹੀ ਚੱਲ ਰਿਹਾ ਕੋਈ ਹੈਂਗ ਨਹੀਂ ਹੋਇਆ ਕੁਛ ਨਹੀਂ ਹੋਇਆ ਕੈਮਰੇ ਦੀ ਵੀ ਕੁਆਲਿਟੀ ਬਹੁਤ ਵਧੀਆ ਬੱਚੇ ਸਾਰਾ ਸਾਰਾ ਦਿਨ ਉਹ ਛੋਟਾ ਤਾਂ ਛੱਡਦਾ ਹੀ ਨਹੀਂ ਫੋਨ ਨੂੰ ਹੱਥ ਹੀ ਰੱਖਦਾ ਸਾਰਾ ਦਿਨ ਗੇਮ ਖੇਡਦਾ ਰਹਿੰਦਾ ਬੈਟਰੀ ਦਾ ਵੀ ਪਿਕਅੱਪ ਬਹੁਤ ਵਧੀਆ ਭਾਅ ਜੀ ਬਹੁਤ ਹੀ ਵਧੀਆ ਫੋਨ ਦਿੱਤਾ ਤੁਸੀਂ ਉਹ ਪਿੱਛੇ ਪੁਰਾਣਾ ਫੋਨ ਸੀ ਉਹ ਇੱਕ ਵਾਰ ਡਿੱਗਿਆ ਸੀ ਉਹਦੇ ਬਾਅਦ ਦੁਬਾਰਾ ਔਨ ਹੀ ਨਹੀਂ ਹੋਇਆ ਅਤੇ ਇਹ ਜਿਹੜਾ ਫੋਨ ਤੁਸੀਂ ਦਿੱਤਾ ਇਹ ਤਾਂ ਬਹੁਤ ਹੀ ਵਧੀਆ ਬੱਚੇ ਨੇ ਕਿੰਨੀ ਵਾਰ ਤਾਂ ਤਿੰਨ ਚਾਰ ਵਾਰ ਤਾਂ ਉਹਨੇ ਸੁੱਟਤਾ ਥੱਲੇ ਫਿਰ ਵੀ ਇਹਨੂੰ ਕੁਛ ਨਹੀਂ ਹੋਇਆ ਬਹੁਤ ਵਧੀਆ ਚਲਦਾ ਪਿਆ ਪਾਣੀ ਵਾਂਗੂੰ ਚੱਲ ਰਿਹਾ ਭਾਅ ਜੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਠੀਕ